ਹੈਲੋ ਕਿਸ ਚੀਜ਼ ਬਾਰੇ ਪੁੱਛਣਾ ਚਾਹੁੰਦੇ ਹੋ ਤੁਸੀਂ ਸਾਡੇ ਤੋਂ ਹਾਂਜੀ ਇਹ ਪਿਛਲੇ ਸਾਲ ਜਿਹੜੇ ਹੜ੍ਹ ਆਏ ਸੀ ਉਹਦੇ ਨਾਲ ਆਪਾਂ ਨੂੰ ਕਾਫੀ ਨੁਕਸਾਨ ਹੋਇਆ ਜੀ ਅਤੇ ਹੜ੍ਹ ਆਉਣ ਦੇ ਨਾਲ ਲੋਕਾਂ ਦੀ ਕਾਫੀ ਫਸਲਾਂ ਖਰਾਬ ਹੋਈਆਂ ਉਹਨਾਂ ਦੀ ਰੋਜ਼ਮੱਰਾ ਦਾ ਕੰਮ ਰੋਜ਼ ਦਾ ਜਿਹੜਾ ਕੰਮਕਾਜ ਸੀ ਉਹ ਵੀ ਕਾਫੀ ਛੁੱਟਿਆ ਉਸ ਦੇ ਨਾਲ ਆਪਾਂ ਨੂੰ ਕਾਫੀ ਪਰੇਸ਼ਾਨੀ ਹੋਈ ਆਪਣੇ ਸਕੂਲ ਦੇ ਬੱਚਿਆਂ ਨੂੰ ਵੀ ਕਾਫੀ ਪਰੇਸ਼ਾਨੀ ਹੋਈ ਉਹਨਾਂ ਦਾ ਸਿਲੇਬਸ ਸੀ ਪਿੱਛੇ ਗਿਆ ਅਤੇ ਉਹਨਾਂ ਨੂੰ ਘਰ ਰਹਿ ਕੇ ਪੜ੍ਹਨਾ ਪਈ ਆ ਕਿ ਕਈਆਂ ਬੱਚਿਆਂ ਨੂੰ ਫੋਨ ਵਿਹਲਾ ਨਹੀਂ ਹੁੰਦਾ ਸੀ ਟੱਚ ਅਤੇ ਉਹਨਾਂ ਦੀ ਪੜ੍ਹਾਈ ਜਿੱਦਾਂ ਵੀ ਉਹਨਾਂ ਨੂੰ ਕਾਫੀ ਨੁਕਸਾਨ ਹੋਇਆ ਇਸ ਹੜ੍ਹ ਆਉਣ ਕਰਕੇ ਕਾਫੀ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ ਅਤੇ ਇਸ ਹੜ੍ਹ ਆਉਣ ਕਰਕੇ ਆਪਾਂ ਨੂੰ ਆਪਣੇ ਰੋਜ਼ਮੱਰਾ ਦੀ ਜ਼ਿੰਦਗੀ ਦੇ ਵਿੱਚ ਆਪਣੇ ਜੋ ਕੰਮ ਚੱਲ ਰਹੇ ਸੀ ਉਹ ਵੀ ਠੱਪ ਹੋ ਗਏ ਕਈ ਘਰਾਂ ਦੀਆਂ ਰੋਜ਼ੀ ਰੋਟੀ ਵੀ ਬੰਦ ਹੋ ਗਈ ਅਤੇ ਆਪਾਂ ਨੂੰ ਕਾਫੀ ਪਰੇਸ਼ਾਨੀ ਹੋਈ ਉਹਦੇ ਬਾਰੇ ਅਸੀਂ ਇਹ ਦੱਸ ਸਕਦੇ ਹਾਂ ਜੀ ਜਦੋਂ ਆਪਣੇ ਵੱਡੇ ਵੱਡੇ ਦਰਿਆਵਾਂ ਦੇ ਵਿੱਚ ਪਾਣੀ ਭਰ ਜਾਂਦਾ ਨੇ ਤਾਂ ਉਹ ਸਰਕਾਰ ਉਹਨਾਂ ਨੂੰ ਨਰਗਾ ਨਹਿਰਾਂ ਦੇ ਵਿੱਚ ਸਪਲਾਈ ਕਰਦੀ ਹੈ ਅਤੇ ਨਹਿਰਾਂ ਜਦੋਂ ਓਵਰਲੋਡ ਹੋ ਜਾਂਦੀਆਂ ਸੀਗੀਆਂ ਤਾਂ ਉਹ ਆਪਣੇ ਪਿੰਡਾਂ ਦੇ ਜਿੱਦਾਂ ਕੋਈ ਬੰਨ੍ਹ ਟੁੱਟ ਜਾਣੇ ਇੱਦਾਂ ਪਿੰਡਾਂ ਕਾਫੀ ਪਿੰਡਾਂ ਦੇ ਵਿੱਚ ਪਾਣੀ ਜਾਣ ਕਰਕੇ ਅਤੇ ਆਪਣੇ ਘਰ ਆਉਣ ਦੇ ਵਿੱਚ ਉਹ ਪਾਣੀ ਜਾਣ ਕਰਕੇ ਆਪਣੀ ਦੁਕਾਨਾਂ ਦੇ ਵਿੱਚ ਪਾਣੀ ਜਾਣ ਕਰਕੇ ਆਪਣੇ ਘਰਾਂ ਦਾ ਵੀ ਨੁਕਸਾਨ ਹੋਇਆ ਅਤੇ ਕਾਫੀ ਇਹ ਦੁਕਾਨਾਂ ਦਾ ਵੀ ਨੁਕਸਾਨ ਹੋਇਆ ਜਿੱਦਾਂ ਕਿ ਘਰਾਂ ਦੀਆਂ ਨੀਂਹਾਂ ਵੀ ਖਰਾਬ ਹੋਈਆਂ ਕਈ ਜਗ੍ਹਾ ਖੜ੍ਹੇ ਖੜ੍ਹੇ ਬਿਲਡਿੰਗਾਂ ਵੀ ਢਹਿ ਗਈਆਂ ਜਿਹਨਾਂ ਕਰਕੇ ਲੋਕਾਂ ਨੂੰ ਦੁਬਾਰਾ ਇਹ ਘਰ ਆਪਣੇ ਬਣਾਉਣੇ ਪਏ ਅਤੇ ਕਈ ਗਰੀਬ ਘਰਾਂ ਦੇ ਤਾਂ ਘਰ ਹੀ ਇੱਦਾਂ ਖਤਮ ਹੋ ਗਏ ਕਿ ਉਹ ਆਪਦੀ ਹੁਣ ਝੁੱਗੀਆਂ ਬਣਾ ਕੇ ਅਤੇ ਉਹਦੇ ਵਿੱਚ ਆਪਦਾ ਗੁਜ਼ਾਰਾ ਕਰਦੇ ਨੇ ਇਹ ਹੜ੍ਹ ਆਉਣ ਕਰਕੇ ਇਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੋਈ ਇਹਨਾਂ ਨੂੰ ਕਾਰੋਬਾਰ ਨੂੰ ਕਈਆਂ ਨੂੰ ਬੰਦ ਹੀ ਕਰਨਾ ਪਿਆ ਦੁਬਾਰਾ ਉਹਨਾਂ ਕੋਲ ਇੰਨੀ ਸੇਲ ਨਹੀਂ ਸੀ ਉਹ ਦੁਬਾਰਾ ਇਹ ਕਾਰੋਬਾਰ ਸ਼ੁਰੂ ਨਹੀਂ ਕਰ ਸਕੇ ਅਤੇ ਇਸ ਹੜ੍ਹ ਨੇ ਕਾਫੀ ਬੰਦਿਆਂ ਦੀ ਇਹ ਉਹ ਜ਼ਿੰਦਗੀ 'ਚ ਉੱਥਲ ਪੁਥਲ ਕਰ ਦਿੱਤੀ ਕਾਫੀ ਕਾਫੀ ਪਰੇਸ਼ਾਨੀ ਹੋਣ ਕਰਕੇ ਇਹਨਾਂ ਨੂੰ ਕਈ ਘਰਾਂ ਦੇ ਰੋਜ਼ੀ ਰੋਟੀ ਵੀ ਬੰਦ ਹੋ ਗਈ ਅਤੇ ਪਰ ਜਦੋਂ ਇਹ ਹੜ੍ਹ ਆਉਂਦੇ ਨੇ ਉਦੋਂ ਲੋਕਾਂ ਨੂੰ ਇੰਨੀ ਪਰੇਸ਼ਾਨੀ ਹੁੰਦੀ ਆ ਉਹ ਆਪਦੀ ਛੱਤਾਂ 'ਤੇ ਜਾ ਕੇ ਗੁਜ਼ਾਰਾ ਕਰਦੇ ਹੈ ਕਾਫੀ ਕਾਫੀ ਦਿਨ ਉਹਨਾਂ ਨੂੰ ਭੁੱਖੇ ਰਹਿਣਾ ਪੈਂਦਾ ਨਹੀਂ ਅਤੇ ਆਪਣੇ ਵੱਡੇ ਸ਼ਹਿਰਾਂ ਦੇ ਇੰਝ ਬਣੇ ਹੋਏ ਆ ਉਹ ਇਕੱਠੇ ਹੋ ਕੇ ਲੋਕਾਂ ਦੀ ਮਦਦ ਕਰਦੇ ਆ ਆਪਦੇ ਆਪਦੀ ਇਨਕਮ 'ਚੋਂ ਇਕੱਠਾ ਕਰਕੇ ਅਤੇ ਉਹ ਲੋਕਾਂ ਨੂੰ ਬਰੈਡ ਵਗੈਰਾ ਹੋਰ ਉਹਨਾਂ ਨੂੰ ਖਾਣ ਪੀਣ ਨੂੰ ਸਮਾਨ ਵਗੈਰਾ ਸਪਲਾਈ ਕਰਦੇ ਆ ਅਤੇ ਲੋਕ ਜਿਹੜੇ ਛੱਤਾਂ 'ਤੇ ਬੈਠੇ ਹੁੰਦੇ ਆ ਉਹਨਾਂ ਨੂੰ ਉੱਥੇ ਹੈਲੀਕਾਪਟਰ ਦੇ ਰਾਹੀਂ ਉਹਨਾਂ ਨੂੰ ਖਾਣਾ ਪਹੁੰਚਾਉਂਦੇ ਨੇ ਹਾਂਜੀ ਸਰਕਾਰ ਦੇ ਜ਼ਰੀਏ ਸਾਰਾ ਕੰਮ ਕੀਤਾ ਜਾਂਦਾ ਨੇ ਜੀ ਹਾਂਜੀ ਠੀਕ ਹੈ ਜੀ